ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ ਮੈਂ ਗੁੜ ਖਰੀਦਣਾ ਸੀ ਤੇ ਗੁੜ ਬਾਰੇ ਥੋੜੀ ਚੀਜ਼ਾਂ ਤੁਹਾਡੇ ਕੋ ਪੁੱਛਣਾ ਚਾਹੁੰਦੀ ਸੀ ਕਿ ਮੈਂ ਸ਼ੱਕਰ ਦਾ ਇਸਤੇਮਾਲ ਕਰਾਂ ਕਿ ਗੁੜ ਦਾ ਇਸਤੇਮਾਲ ਕਰਾਂ ਉਹ ਤਾਂ ਬਹੁਤ ਵਧੀਆ ਪਰ ਗੁੜ ਬਹੁਤ ਤਰਹਾਂ ਦੇ ਮਿਲਦੇ ਪਏ ਆ ਅੱਜਕਲ ਬਾਜ਼ਾਰਾਂ ਚ ਨਾ ਤੇ ਮੈਨੂੰ ਇਹੀ ਨਹੀਂ ਸਮਝ ਆਉਂਦਾ ਕਿਹੜਾ ਗੁੜ ਵਧੀਆ ਜਿਹੜਾ ਘਰ ਲੈ ਕੇ ਆਵਾਂ ਕਿਹੜਾ ਖਾਣ ਦੇ ਕੰਮ ਆਏਗਾ ਕਿਹੜਾ ਮੈਂ ਚਾਹ ਚ ਪਾਉਣ ਦੇ ਕੰਮ ਆਏ ਮੈਨੂੰ ਸਮਝ ਨਹੀਂ ਆ ਰਿਹਾ ਇਹਦਾ ਮੈਂ ਬਹੁਤ ਵਧੀਆ ਜੀ ਪਰ ਐ ਨਾ ਮੈਂ ਅੱਜ ਕੱਲ ਦੇਖਿਆ ਬਾਜ਼ਾਰ ਚ ਨਾ ਗੁੜ ਕਹਿੰਦੇ ਗੁੜ ਦਾ ਨਾਮ ਹੈ ਰੰਗ ਵਿੱਚ ਇਦਾ ਹੁੰਦਾ ਪਰ ਉਹਦੇ ਵਿੱਚ ਮਿਲੀ ਚੀਨੀ ਜਿਹੀ ਹੁੰਦੀ ਹੈ ਮੈਂ ਚੀਨੀ ਬਿਲਕੁਲ ਨਹੀਂ ਇਸਤੇਮਾਲ ਕਰਨ ਚ ਯਕੀਨ ਕਰਤੀ ਮੈਨੂੰ ਦੱਸੋ ਕਿ ਬਿਨਾਂ ਚੀਨੀ ਜਾਂ ਚੀਨੀ ਦੇ ਮਾਤਰਾ ਕਿੰਨੀ ਹੁੰਦੀ ਤੁਹਾਡੇ ਗੁੜ ਚ ਤੇ ਮੈਂ ਭੈਣ ਜੀ ਇਹ ਮੇਰੇ ਲਈ ਬਹੁਤ ਚੰਗਾ ਹੋ ਜਾਏਗਾ ਜੇ ਤੁਸੀਂ ਮੈਨੂੰ ਆਪਣਾ ਪਤਾ ਭੇਜ ਦਵੋਗੇ ਮੈਂ ਗੁੜ ਆਪਣੀ ਅੱਖੀ ਕਢਵਾ ਕੇ ਲਿਆਣਾ ਪਸੰਦ ਕਰਾਂਗੀ ਤੁਸੀਂ ਮੇਰੇ ਪਰਿਵਾਰ ਦੇ ਵਿੱਚ ਮੇਰੇ ਬੱਚਿਆਂ ਲਈ ਵੀ ਮੈਂ ਗੁੜੇ ਲੈਣਾ ਮੈਂ ਆਪਣੇ ਵੱਡੇ ਬਜ਼ੁਰਗਾਂ ਲਈ ਵੀ ਗੁੜ ਲੈਣਾ ਮੈਂ ਉਸੇ ਹਿਸਾਬ ਦਾ ਸਾਡੇ ਕੋਲ ਖੜੇ ਹੋ ਕੇ ਕਢਵਾਉਣਾ ਪਸੰਦ ਕਰਾਂਗੀ ਆਹ ਜਿਹੜਾ ਚੀਨੀ ਖਾਣ ਦੇ ਨਾਲ ਲੋਕਾਂ ਨੂੰ ਬਦਹਜਮੀ ਹੁੰਦੀ ਹ ਉਹਦਾ ਤਾਂ ਨਹੀਂ ਕੋਈ ਇਹਦਾ ਹਿਸਾਬ ਤੇ ਜੇ ਇਨਾ ਵਧੀਆ ਗੁੜ ਐ ਮੈਂ ਬਸ ਇੱਕ ਹੁਣ ਚੀਜ਼ ਮੈਨੂੰ ਤੁਹਾਡੇ ਤੇ ਮੈਨੂੰ ਯਕੀਨ ਦਵਾ ਦੋ ਤਾਂ ਮੈਂ ਤੁਹਾਡੇ ਕੋਲ ਪਹੁੰਚ ਜਾਵਾਂ ਗੁੜ ਤੁਹਾਡਾ ਬਹੁਤਾ ਮਹਿੰਗਾ ਤਾਂ ਨਹੀਂ ਹੈਗਾ ਕਿਸ ਭਾਅ ਲਾਉਂਦੇ ਹੋ ਤੁਸੀਂ ਗੁੜ ਨੂੰ ਨਹੀਂ ਤੁਸੀਂ ਜਿਹੜਾ ਮੈਨੂੰ ਵੱਖ ਵੱਖ ਤਰ੍ਹਾਂ ਦੇ ਗੁੜ ਜਿਵੇਂ ਮੈਂ ਲੈਣੇ ਐ ਉਹਨਾਂ ਦੇ ਮੈਨੂੰ ਜਿਹੜੇ ਭਾਅ ਆ ਇੱਕੋ ਜਿਹੇ ਲਾਓਗੇ ਕਿ ਵੱਖ ਵੱਖ ਲਾਓਗੇ ਮੈਨੂੰ ਬਸ ਹੁਣ ਐਹ ਦੱਸੋ ਤੁਹਾਡਾ ਗੁੜ ਭੂਰੇ ਰੰਗ ਦਾ ਕਿ ਭੂਰੇ ਵਿੱਚ ਬਹੁਤ ਜਿਆਦਾ ਕਾਲੇ ਰੰਗ ਦਾ ਗੁੜ ਆਉਂਦਾ ਕਿਹੜਾ ਰੰਗ ਦਾ ਤੁਸੀਂ ਗੁੜ ਵੇਚਦੇ ਓ ਚਲੋ ਬੋ ਬਹੁਤ ਵਧੀਆ ਜੀ ਭੈਣ ਜੀ ਸ਼ੁਕਰੀਆ